ਅਗਰ ਆਪਾਂ ਚਾਹੁੰਦੇ ਹਾਂ ਕਿ ਅਸੀਂ ਲੰਮਾ ਜੀਏ ਇਹ ਸਾਡੀ ਉਮਰ ਲੰਬੀ ਹੋਵੇ ਅਤੇ ਤੰਦਰੁਸਤ ਰਹੀਏ ਸਾਰੀ ਜ਼ਿੰਦਗੀ ਤਾਂ ਆਪਾਂ ਨੂੰ ਬਾਜ਼ਾਰ ਦਾ ਸਾਰਾ ਕੁਛ ਛੱਡਣਾ ਪਊਗਾ ਜੋ ਵੀ ਪੀਜ਼ਾ ਬਰਗਰ ਸਮੋਸੇ ਪੈਟੀਆਂ ਪਕੌੜੇ ਇਹ ਸਾਰਾ ਕੁਝ ਛੱਡਣਾ ਪਊਗਾ ਕਿਉਂਕਿ ਇਹ ਸਾਡੀ ਉਮਰ ਨੂੰ ਲੰਬਾ ਨਹੀਂ ਕਰਨਗੇ ਨਾ ਹੀ ਅਸੀਂ ਇਹਨਾਂ ਨਾਲ ਤੰਦਰੁਸਤ ਹਾਂ ਅਸੀਂ ਤੰਦਰੁਸਤ ਹਾਂ ਘਰ ਦੇ ਬਣੇ ਖਾਣੇ ਨਾਲ ਦਾਲਾਂ ਨਾਲ ਸਬਜ਼ੀਆਂ ਹਰੀਆਂ ਨਾਲ ਫਲਾਂ ਨਾਲ ਫਰੂਟਸ ਨਾਲ ਜੂਸ ਪੀਓ ਗੰਨੇ ਦਾ ਜੂਸ ਪੀਓ ਲੱਸੀ ਦੇਸੀ ਖੁਰਾਕ ਜਿਹਨੂੰ ਆਪਾਂ ਕਹਿ ਸਕਦੇ ਨਾ ਦੇਸੀ ਖੁਰਾਕ ਉਹ ਖਾਵਾਂਗੇ ਤਾਂ ਅਸੀਂ ਸੌ ਪਰਸੈਂਟ ਤੰਦਰੁਸਤ ਰਹਾਂਗੇ ਖੁਸ਼ ਰਹਾਂਗੇ ਮਿੱਠਾ ਘੱਟ ਕਰ ਲਓ ਆਪਦੀ ਜ਼ਿੰਦਗੀ ਦੇ ਵਿੱਚ ਸੈਰ ਜ਼ਰੂਰ ਕਰੋ ਚਾਹੇ ਸਵੇਰੇ ਚਾਹੇ ਸ਼ਾਮ ਨੂੰ ਜਿੱਦਾਂ ਵੀ ਆਪਾਂ ਨੂੰ ਟਾਈਮ ਮਿਲਦਾ ਉਦਾਂ ਕਰੋ ਸਵੇਰੇ ਕਰੋ ਅਗਰ ਟਾਈਮ ਹੈਗਾ ਤਾਂ ਸਵੇਰੇ ਚਲੇ ਜਾਓ ਖਾਣਾ ਖਾਣ ਤੋਂ ਬਾਅਦ ਵੀ ਰਾਤ ਨੂੰ ਅੱਧਾ ਪੌਣਾ ਘੰਟਾ ਜ਼ਰੂਰ ਘੁੰਮੋ ਇਹਦੇ ਨਾਲ ਕੀ ਆ ਕਿ ਆਪਣਾ ਜਿਹੜਾ ਖਾਣਾ ਖਾਧਾ ਹੋਇਆ ਉਹ ਪਚ ਜਾਂਦਾ ਨੀਂਦ ਵਧੀਆ ਆਉਂਦੀ ਆ ਹੋਰ ਤਾਂ ਤੰਦਰੁਸਤ ਰਹਾਂਗੇ ਕੋਈ ਬਿਮਾਰੀਆਂ ਨਹੀਂ ਲੱਗਣਗੀਆਂ ਦਵਾਈਆਂ ਬੂਟੀਆਂ ਤੋਂ ਆਪਣਾ ਖਹਿੜਾ ਛੁੱਟ ਜਾਊਗਾ ਪਾਣੀ ਵੱਧ ਤੋਂ ਵੱਧ ਪੀਓ ਕਹਿੰਦੇ ਹਾਂ ਨਾ ਕਿ ਬਿਮਾਰੀ ਨੂੰ ਖਤਮ ਕਰਨਾ ਨਾ ਤਾਂ ਪਾਣੀ ਅੱਧੀ ਬਿਮਾਰੀ ਖਤਮ ਕਰ ਦਿੰਦਾ ਅੱਧੀ ਕੀ ਪੌਣੀ ਛੱਡ ਕਰ ਦਿੰਦਾ ਵਾ ਬਸ ਪਾਣੀ ਨੂੰ ਬੈਠ ਕੇ ਪੀਓ

ਆਈਸਕ੍ਰੀਮ ਮਿੱਠਾ ਜਿੰਨਾ ਮਰਜ਼ੀ ਦੇ ਦਿਓ ਉਹਨਾਂ ਲਈ ਉਨਾ ਹੀ ਘੱਟ ਆ ਪਰ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਬੱਚਿਆਂ ਨੂੰ ਘਰ ਦਾ ਬਣਿਆ ਹੋਇਆ ਹੀ ਖਿਲਾਵਾਂ ਜਿੱਦਾਂ ਦਾ ਵੀ ਬਣਾਵਾਂ ਉਹ ਘਰ ਦਾ ਬਣਿਆ ਹੋਇਆ ਖਾ ਖੁਸ਼ ਵੀ ਹੋ ਜਾਂਦੇ ਆ ਅਤੇ ਹਰੀਆਂ ਸਬਜ਼ੀਆਂ ਵੱਧ ਤੋਂ ਵੱਧ ਖਾਓ ਘੀਆ ਤੋਰੀਆਂ ਕੱਦੂ ਕਰੇਲੇ ਸ਼ਿਮਲਾ ਮਿਰਚਾਂ ਬਹੁਤ ਆ ਬਹੁਤ ਕੁਛ ਆ ਖਾਣ ਨੂੰ ਅਗਰ ਆਪਾਂ ਖਾਣਾ ਚਾਹੀਏ ਤਾਂ ਇਹ ਤਾਂ ਸਾਡੇ 'ਤੇ ਆ ਕਿ ਅਸੀਂ ਆਪਦਾ ਮਨ ਅਤੇ ਅਤੇ ਦਿਮਾਗ ਆ ਜਿਹੜਾ ਦਿਲ ਆ ਉਹਨੂੰ ਕਿਹੜੇ ਪਾਸੇ ਲਾਉਂਦੇ ਹਾਂ ਆਪਾਂ ਉਹਨੂੰ ਜਿਹੜੇ ਪਾਸੇ ਲਾਵਾਂਗੇ ਆਪਣਾ ਸਰੀਰ ਇੱਕ ਮਿੱਟੀ ਦੀ ਤਰ੍ਹਾਂ ਵਾ ਮਿੱਟੀ ਓ ਬਣਨਾ ਬਾਅਦ 'ਚ ਵੀ ਇੱਕ ਮਿੱਟੀ ਦੀ ਤਰ੍ਹਾਂ ਵਾ ਜਿੱਧਰ ਨੂੰ ਢਾਲੋਗੇ ਉੱਧਰ ਨੂੰ ਢਲ ਜਾਊਗਾ ਅਤੇ ਜੇ ਤੁਸੀਂ ਚੀਜ਼ਾਂ ਹੀ ਬਾਜ਼ਾਰ ਦੀਆਂ ਖਾਂਦੇ ਰਹੋਗੇ ਉੱਥੇ ਢਲ ਜਾਊਗਾ ਬਾਅਦ 'ਚ ਤੁਹਾਨੂੰ ਘਰ ਦੀ ਚੀਜ਼ ਵਧੀਆ ਨਹੀਂ ਲੱਗਣੀ ਵੱਧ ਤੋਂ ਵੱਧ ਆਪਦੀ ਸਿਹਤ ਵੱਲ ਧਿਆਨ ਦਿਓ ਐਕਸਰਸਾਈਜ਼ ਕਰੋ ਯੋਗਾ ਕਰੋ ਟਾਈਮ ਕੱਢੋ ਆਪਦੇ ਲਈ ਆਪਦੀ ਸਿਹਤ ਵਾਸਤੇ ਤੰਦਰੁਸਤੀ ਲਈ ਆਪਦੇ ਤੰਦਰੁਸਤ ਰਹਿਣਾ ਤਾਂ ਉਹਦੇ ਲਈ ਟਾਈਮ ਕੱਢਣਾ ਪਊਗਾ ਸੈਰ ਕਰੋ ਬਹੁਤ ਜ਼ਰੂਰੀ ਹੈ ਚਾਹੇ ਪੰਦਰਾਂ ਵੀਹ ਮਿੰਟ ਹੀ ਕਰ ਲਓ ਪਰ ਖਾਣਾ ਖਾਣ ਤੋਂ ਬਾਅਦ ਸੈਰ ਜ਼ਰੂਰ ਕਰੋ ਤੰਦਰੁਸਤ ਰਹਿਣ ਵਾਸਤੇ